ਪੰਜਾਬੀ ਪੰਜਾਬੀ ਵਿੱਚ ਸੰਗੀਤ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੰਗੀਤ ਵਿੱਚ ਪੰਜਾਬੀ ਗਾਣੇ ਬਹੁਤ ਪੋਪੂਲਰ ਹੈ ਪੰਜਾਬੀ ਗੀਤ ਸੰਗੀਤ ਸੁਣ ਕੇ ਇਨਸਾਨ ਨੂੰ ਦਿਲ ਖੁਸ਼ ਹੋ ਜਾਂਦਾ ਹੈ ਬਹੁਤ ਜ਼ਿਆਦਾ ਇੱਕ ਸਕੂਨ ਮਿਲਦਾ ਹੈ ਡਾਂਸ ਪੰਜਾਬ ਵਿੱਚ ਡਾਂਸ ਨੂੰ ਵੀ ਇੱਕ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਡਾਂਸ ਵਿੱਚ ਆਉਂਦਾ ਹੈ ਭੰਗੜਾ ਗਿੱਧਾ ਐ ਕੁੜੀਆਂ ਗਿੱਧਾ ਕਰਨਾ ਬੜਾ ਖੁਸ਼ ਹੋ ਕੇ ਗਿੱਧਾ ਕਰਦੀਆਂ ਗਿੱਧਾ ਕਰਨਾ ਬੜਾ ਪਸੰਦ ਕਰਦੀਆਂ ਭੰਗੜੇ ਵਿੱਚ ਮੁੰਡੇ ਬਹੁਤ ਖੁਸ਼ ਹੋ ਕੇ ਭੰਗੜਾ ਪਾਉਣਾ ਪਸੰਦ ਕਰਦੇ ਆ ਸਿਨਮਾ ਸਿਨਮੇ ਵਿੱਚ ਪੰਜਾਬੀ ਮੂਵੀ ਦੇਖਣਾ ਲੋਕਾਂ ਨੂੰ ਬਹੁਤ ਪਸੰਦ ਹੈ ਅੱਜ ਕੱਲ੍ਹ ਦੇ ਲੋਕ ਫੋਨ ਦੇ ਵਿੱਚ ਹੀ ਮੋਬਾਈਲ ਦੇ ਵਿੱਚ ਹੀ ਆਪਣੀ ਮੂਵੀ ਵਗੈਰਾ ਦੇਖ ਲੈਂਦੇ ਆ ਪੰਜਾਬੀ ਮੂਵੀ ਕੋਈ ਵੀ ਨਵੀਂ ਆਉਂਦੀ ਹੈ ਲੋਕ ਪਹਿਲੇ ਹੀ ਉਹਨੂੰ ਦੇਖ ਲੈਂਦੇ ਹੈ ਬਾਅਦ 'ਚ ਉਹਨੂੰ ਥਿਏਟਰ ਵਿੱਚ ਵੀ ਇੰਜੋਏ ਕਰਦੇ ਆ ਜਾ ਕੇ ਪੰਜਾਬ 'ਚ ਇਹ ਚੀਜ਼ਾਂ ਦਾ ਬਹੁਤ ਇੱਕ ਮਹੱਤਵ ਹੈਗਾ ਸੰਗੀਤ ਹੋ ਗਿਆ ਡਾਂਸ ਹੋ ਗਿਆ ਸਿਨਮਾ ਹੋ ਗਿਆ ਇਹਨਾਂ ਚੀਜ਼ਾਂ ਦਾ ਪੰਜਾਬ ਵਿੱਚ ਬਹੁਤ ਮਹੱਤਵ ਹੈਗਾ ਪੰਜਾਬ ਵਿੱਚ ਹਰ ਇੱਕ ਚੀਜ਼ ਨੂੰ ਮਹੱਤਵ ਦਿੱਤਾ ਜਾਂਦਾ ਹੈ ਉਹ ਪੰਜਾਬੀਆਂ ਦੀ ਸ਼ਾਨ ਹੈ ਹੈਂ ਪੰਜਾਬੀ ਹੈ ਰੰਗਮੰਚ ਮੇਲਾ ਪੰਜਾਬੀਆਂ ਦੀ ਇੱਕ ਸ਼ਾਨ ਹੈਗੀ ਆ ਪੰਜਾਬੀ ਲੋਕ ਬੜਾ ਖੁਸ਼ ਹੁੰਦੇ ਆ ਜਿੱਥੇ ਜਿੱਥੇ ਮੇਲਾ ਹੋਏ ਰੰਗਮੰਚ ਹੋਏ ਉੱਥੇ ਪੰਜਾਬੀ ਲੋਕ ਬਹੁਤ ਖੁਸ਼ ਹੁੰਦੇ ਹਨ